ਇੱਕ ਵਾਰ ਅਸੀਂ ਫੈਮਲੀ ਟ੍ਰਿਪ 'ਤੇ ਹਿਲੀ ਏਰੀਆ ਵਿੱਚ ਗਏ ਹੋਏ ਸੀ ਅਤੇ ਉਸ ਦਿਨ ਮੈਂ ਵ ਯੋਗਾ ਕਰਨੀ ਸੀ ਮੈਂ ਆਪਣਾ ਮੈਟ ਲੈ ਕੇ ਬਾਹਰ ਚਲੀ ਗਈ ਮੈਂ ਪਹਾੜ ਦੇ ਉੱਤੇ ਯੋਗਾ ਕੀਤੀ ਮੈਂ ਪਹਿਲਾਂ ਤਾਂ ਇੱਕ ਸਾਫ਼ ਜਗ੍ਹਾ ਦੇਖੀ ਕਿ ਜਿੱਥੇ ਮੈਂ ਯੋਗਾ ਕਰ ਸਕਾਂ ਮੈਂ ਮੈਟ ਵਿਛਾਇਆ ਅਤੇ ਆਪਣੀ ਯੋਗਾ ਸ਼ੁਰੂ ਕੀਤੀ ਉਹ ਮੇਰਾ ਬਹੁਤ ਹੀ ਵਧੀਆ ਐਕਸਪੀਰੀਐਂਸ ਸੀ ਮੈਨੂੰ ਸਾਹਮਣੇ ਸਨਰਾਈਜ਼ ਦਿਖ ਰਿਹਾ ਸੀ ਠੰਡੀ ਠੰਡੀ ਹਵਾ ਚੱਲ ਰਹੀ ਸੀ ਅਤੇ ਮੇਰੀ ਯੋਗਾ ਕਰਨ ਦਾ ਮਜ਼ਾ ਦੁੱਗਣਾ ਹੋ ਗਿਆ ਮੈਨੂੰ ਬਹੁਤ ਹੀ ਵਧੀਆ ਲੱਗਿਆ ਕਿ ਅਸੀਂ ਜਦੋਂ ਖੁੱਲੇ ਆਸਮਾਨ ਦੇ ਅੰਦਰ ਯੋਗਾ ਕਰਦੇ ਹਾਂ ਤਾਂ ਸਾਨੂੰ ਔਕਸੀਜਨ ਵੀ ਪੂਰੀ ਅੱਛੀ ਤਰ੍ਹਾਂ ਮਿਲਦੀ ਹੈ